ਸ ਸਾਡੇ ਘਰ ਕੋਈ ਮਹਿਮਾਨ ਆ ਜਾਵੇ ਤਾਂ ਸਾਨੂੰ ਚਾਅ ਚੜ੍ਹ ਜਾਂਦਾ ਏ ਵੀ ਸਾਡੇ ਘਰ ਕੋਈ ਮਹਿਮਾਨ ਆਇਆ ਏ ਜਿਸ ਤਰਾਂ ਕਿ ਪੁਰਾਣੀ ਕਹਾਵਤ ਹੈ ਸਿਆਣਿਆਂ ਦੀ ਘਰ ਆਇਆ ਅੰਮਾ ਜਾਇਆ ਮਹਿਮਾਨ ਇਕ ਰੱਬ ਦਾ ਰੂਪ ਹੁੰਦਾ ਏ ਅਤੇ ਜਦੋਂ ਘਰ ਆਉਂਦਾ ਏ ਤਾਂ ਸਾਨੂੰ ਬਹੁਤ ਜ਼ਿਆਦਾ ਚਾਅ ਚੜ੍ਹਦਾ ਹੈ ਕਿ ਸਾਡੇ ਘਰ ਕੋਈ ਮਹਿਮਾਨ ਆਇਆ ਏ ਅਤੇ ਅਸੀਂ ਉਹਨਾਂ ਦਾ ਗੱਜ ਵੱਜ ਕੇ ਸਵਾਗਤ ਕਰਦੇ ਹਾਂ ਅਤੇ ਉਹਨਾਂ ਨੂੰ ਆਓ ਭਗਤ ਕਰਨਾ ਬਿਠਾ ਕੇ ਬਿਠਾਲਦੇ ਹਾਂ ਬਿਠਾਲ ਕੇ ਉਹਨਾਂ ਨੂੰ ਕੋਲਡ ਡ੍ਰਿੰਕ ਦੇਣਾ ਪਹਿਲਾਂ ਪਾਣੀ ਦਈ ਦਾ ਫਿਰ ਕੋਲਡ ਡ੍ਰਿੰਕ ਸਰਵ ਕਰੀ ਦਾ ਫਿਰ ਉਸ ਤੋਂ ਬਾਅਦ ਗੱਲਾਂ ਗੁੱਲਾਂ ਮਾਰੀ ਦੀਆਂ ਗੱਪਾਂ ਮਾਰੀ ਦੀਆਂ ਫਿਰ ਉਸ ਤੋਂ ਬਾਅਦ ਆਪਾਂ ਚਾਹ ਕੌਫੀ ਜੋ ਵੀ ਹੈ ਜ਼ਿਆਦਾਤਰ ਤਾਂ ਕ ਜੋ ਚਾਹ ਪੀਣਾ ਪਸੰਦ ਕਰਦੇ ਆ ਉਹਨਾਂ ਨੂੰ ਚਾਹ ਜੋ ਕੌਫੀ ਪੀਂਦੇ ਉਹਨਾਂ ਨੂੰ ਕੌਫੀ ਠੀਕ ਹੈ ਅਤੇ ਉਹਦੇ ਨਾਲ਼ ਆਪਾਂ ਕਈ ਵਾਰ ਸਮੋਸੇ ਮੰਗਵਾ ਲਈ ਦੇ ਹੈ ਕਈ ਵਾਰ ਆਪਾਂ ਸੈਂਡਵਿਚ ਬਣਾ ਲੈਂਦੇ ਹੈ ਅਤੇ ਨਮਕੀਨ ਰੱਖ ਦਈ ਦੀ ਹੈ ਬਿਸਕੁਟ ਮੰਗਵਾ ਲੈਂਦੇ ਹਾਂ ਤਰ੍ਹਾਂ ਤਰ੍ਹਾਂ ਦੇ ਚੀਜ਼ਾਂ ਜਿਸ ਤਰ੍ਹਾਂ ਕਿ ਹੁਣ ਤੁਹਾਨੂੰ ਦੱਸਿਆ ਹੀ ਹੈ ਅਤੇ ਬਾਕੀ ਪਕੌੜੇ ਵੀ ਕੱਢ ਲਈ ਦੇ ਹੈ ਇਹ ਜਿਹੀ ਕੋਈ ਗੱਲ ਨਹੀਂ ਹੈਗੀ ਬੀ ਮਜਾ ਆ ਜਾਂਦਾ ਜਾਣੀ ਉਹਨਾਂ ਦੇ ਵਾਸਤੇ ਆਪਾਂ ਕੁਛ ਕਰਦੇ ਹਾਂ ਤਾਂ ਆਪਾਂ ਵੀ ਖਾਣ ਦਾ ਮੌਕਾ ਮਿਲ ਜਾਂਦਾ ਏ ਅਤੇ ਉਸ ਤੋਂ ਬਾਅਦ ਆਪਾਂ ਉਹਨਾਂ ਨੂੰ ਚਾਹ ਪਾਣੀ ਦਿੰਦੇ ਹਾਂ ਇੰਨੇ ਨੂੰ ਦੁਪਹਿਰ ਦਾ ਹੋ ਜਾਂਦਾ ਗੱਲਾਂ ਬਾਤਾਂ ਮਾਰ ਕੇ ਪਹਿਲਾਂ ਹੀ ਤਿਆਰੀ ਕਰ ਲਈ ਦੀ ਹੈ ਵੀ ਹਾਂ ਚਲੋ ਕਿਸੇ ਨੇ ਆਉਣਾ ਏ ਦਾਲ਼ ਸਬਜ਼ੀ ਧਰਦੇ ਹਾਂ ਆਲੂ ਮਟਰ ਬਣਾ ਲਈ ਦੀ ਹੈ ਇੱਕ ਸੁੱਕੀ ਸਬਜ਼ੀ ਬਣਾ ਲੈਂਦੇ ਹਾਂ ਬੂੰਦੀ ਦਹੀਂ ਬਣਾ ਲਈ ਦਾ ਦਹੀਂ ਦੇ ਵਿੱਚ ਆਪਾਂ ਖੀਰੇ ਕੱਟ ਕੇ ਟਮਾਟਰ ਕੱਟ ਕੇ ਪਿਆਜ਼ ਕੱਟ ਕੇ ਆਪਾਂ ਰਾਇਤਾ ਤਿਆਰ ਕਰ ਲਈ ਦਾ ਅਤੇ ਇੱਕ ਸਵੀਟ ਡਿਸ਼ ਬਣਾ ਲਈ ਦੀ ਹੈ ਜਿਸ ਤਰ੍ਹਾਂ ਕਿ ਹਲਵਾ ਕਹਿ ਲਓ ਜਾਂ ਫਿਰ ਸੇਵੀਆਂ ਬਣਾ ਲਈ ਦੀਆਂ ਦੁੱਧ ਦੇ ਵਿੱਚ ਪੁਰਾਣੇ ਜ਼ਮਾਨੇ 'ਚ ਤਾਂ ਮਤਲਬ ਕਿ ਸ਼ੱਕਰ ਰਲ਼ਾ ਲੈਂਦੇ ਹੁੰਦੇ ਦੇਸੀ ਘਿਓ ਪਾ ਕੇ ਹੈ ਨਾ ਵੀ ਕੋਈ ਆਇਆ ਚਾਅ ਚੜ੍ਹ ਜਾਂਦਾ ਉਹੀ ਉਸ ਤਰ੍ਹਾਂ ਹੀ ਹੁਣ ਆਪਾਂ ਨੂੰ ਹੀ ਆਦਤ ਪਈ ਹੋਈ ਹੈ ਮਹਿਮਾਨ ਨਵਾਜੀ ਆਪਾਂ ਕਰਦੇ ਹਾਂ ਤਾਂ ਬਹੁਤ ਮਜ਼ਾ ਆਉਂਦਾ ਮਨ ਨੂੰ ਸ਼ ਖੁਸ਼ੀ ਮਿਲਦੀ ਹੈ ਇੱਕ ਵੀ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਤਾਂ ਇੱਦਾਂ ਹੈ ਵੀ ਕੋਈ ਆਉਂਦਾ ਕੋਈ ਨਹੀਂ ਆਉਂਦਾ ਮਹਿਮਾਨ ਅੱਜ ਕੱਲ੍ਹ ਦਾ ਟਾਈਮ ਹੀ ਨਹੀਂ ਹੁੰਦਾ ਅੱਜ ਕੱਲ੍ਹ ਕਿਸੇ ਕੋਲ ਇੰਨਾਂ ਠੀਕ ਹੈ ਅਤੇ ਜਦੋਂ ਕੋਈ ਆਉਂਦਾ ਤਾਂ ਸਾਨੂੰ ਤਾਂ ਚਾਅ ਚੜ੍ਹ ਜਾਂਦਾ ਵੀ ਸਾਡੇ ਘਰ ਕੋਈ ਮਹਿਮਾਨ ਆਇਆ ਏ ਅਤੇ ਸ਼ਾਮ ਨੂੰ ਫਿਰ ਚ ਚਾਹ ਦਾ ਟਾਈਮ ਹੋ ਜਾਂਦਾ ਫਿਰ ਨਾਲ ਕੁਝ ਹੋਰ ਮੰਗਵਾ ਲਈ ਦਾ ਅੱਜ ਕੱਲ੍ਹ ਦੇ ਟਾਈਮ ਦਾ ਫਾਸਟ ਫੂਡ ਚੱਲ ਗਏ ਆ ਸਪ੍ਰਿੰਗ ਰੋਲ ਖਾ ਲਉ ਪਰ ਨਹੀਂ ਅਸੀਂ ਤਾਂ ਆਪਣੇ ਘਰ ਦੀਆਂ ਚੀਜ਼ਾਂ ਹੀ ਬਣਾਉਣਾ ਪਸੰਦ ਕਰਦੇ ਹਾਂ